ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਅਸੀਂ ਕੋਈ ਨਹੀਂ ਤੁਹਾਡੀ ਅਸੀਂ ਗੱਲ ਚੁੱਕਾਂਗੇ ਕਮੇਟੀ ਘਰ ਜਾਵਾਂਗੇ ਅਸੀਂ ਉਹਨਾਂ ਨੂੰ ਬੋਲਾਂਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਅਤੇ ਕੋਈ ਨਹੀਂ ਅਸੀਂ ਕਰਾਂਗੇ ਗੱਲ ਕਮੇਟੀ ਘਰ ਜਾ ਕੇ ਤੁਹਾਡੀ ਕਿੱਦਾਂ ਦਾ ਮਤਲਬ ਕਿ ਬਹੁਤ ਮੱਛਰ ਵਗੈਰਾ ਉੱਥੇ ਉਹਨਾਂ ਨੇ ਇੱਦਾਂ ਕੰਪਲੇਨ ਕੀਤੀ ਹੈਗੀ ਆ ਹਾਂਜੀ ਹਾਂਜੀ ਹਾਂਜੀ ਕੋਈ ਨਹੀਂ ਅਸੀਂ ਤੁਹਾਡੀ ਗੱਲ ਹਾਂਜੀ ਕੋਈ ਨਹੀਂ ਅਸੀਂ ਤੁਹਾਡੀ ਗੱਲ ਚੁੱਕਾਂਗੇ ਕਮੇਟੀ ਘਰ ਜਾ ਕੇ ਉਹਨਾਂ ਨੂੰ ਬੋਲਾਂਗੇ ਕਿ ਇੱਦਾ ਇੱਦਾ ਕਿਆ ਸਹੀ ਆ ਹਾਂਜੀ ਠੀਕ ਹੈ